ਹਾਂ ਮੈਂ ਭੌਤਿਕ ਕਿਤਾਬਾਂ ਨਾਲੋਂ ਇਲੈਕਟ੍ਰੋਨਿਕ ਸੰਸਕਰਨਾਂ ਨੂੰ ਪੜ੍ਹਨਾ ਪਸੰਦ ਕਰਦਾ ਹਾਂ ਕਿਉਂਕਿ ਮੈਂ ਨਿਯਮਤ ਕਿਤਾਬਾਂ ਨਾਲੋਂ ਓਡੀਓ ਬੁੱਕਾਂ ਨੂੰ ਤਰਜੀਹ ਦਿੰਦਾ ਹਾਂ ਕਿਉਂਕਿ ਮੈਂ ਕਿਤਾਬਾਂ ਦੀ ਸਮੱਗਰੀ ਨੂੰ ਜਜਬ ਕਰਦੇ ਹੋਏ ਭੋਜਨ ਡਰਾਈਵਿੰਗ ਅਤੇ ਕਸਰਤ ਵਰਗੇ ਬੁਨਿਆਦੀ ਅਤੇ ਦੁਹਰਾਉਣ ਵਾਲੇ ਕੰਮ ਕਰ ਸਕਦਾ ਹਾਂ ਮੈਂ ਆਪਣੇ ਆਪ ਨੂੰ ਵੀ ਚੰਗੀ ਤਰ੍ਹਾਂ ਪੜ੍ਹਿਆ ਲਿਖਿਆ ਕਹਾਂਗਾ ਕਿਉਂਕਿ ਮੈਂ ਸਿਰਫ ਕਿਤਾਬਾਂ ਦੇ ਨਾਂ ਨਾਲ ਨਾਲ ਆਡੀਓ ਸੰਸਕਰਨਾਂ ਨੂੰ ਹੀ ਸੁਣਦਾ ਹਾਂ ਆਡੀਓ ਬੁੱਕਾਂ ਸੁਰਨ ਦੇ ਨਾਲ ਸਾਨੂੰ ਬਹੁਤ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਕਈ ਦੁਨੀਆਂ ਭਰ ਦੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ ਕਿਉਂਕਿ ਜੇਕਰ ਲੋਕ ਸਿਰਫ ਕਿਤਾਬਾਂ ਹੀ ਪੜ੍ਹਦੇ ਹਨ ਭੌਤਿਕ ਕਿਤਾਬਾਂ ਹੀ ਪੜ੍ਹਦੇ ਹਨ ਤਾਂ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਆਡੀਓ ਬੁੱਕਾਂ ਨੂੰ ਹੀ ਤਰਜੀਹ ਦਿੱਤਾ ਜਾਂਦਾ ਹੈ ਆਡੀਓ ਬੁੱਕਾਂ ਪੜ੍ਹਨ ਨਾਲ ਜਾਂ ਸੁਣਨ ਨਾਲ ਸਾਨੂੰ ਭੌਤਿਕ ਅਤੇ ਰਸਾਇਣਿਕ ਗਿਆਨ ਦੋਨੋਂ ਪ੍ਰਾਪਤ ਹੁੰਦੇ ਹਨ ਆਡੀਓ ਬੁੱਕਾਂ ਪੜ੍ਹਨ ਵਾਲਾ ਵਿਅਕਤੀ ਰਵਾਇਤੀ ਦੇ ਨਾਲ ਬਹੁਤ ਤੇਜ਼ ਹੁਸ਼ਿਆਰ ਅਤੇ ਸਮੇਂ ਦੇ ਨਾਲ ਬਿਹਤਰੀਨ ਹੁੰਦਾ ਹੈ ਉਹ ਆਉਣ ਵਾਲੇ ਫਿਊਚਰ ਦੇ ਵਿੱਚ ਆਡੀਓ ਬੁੱਕਾਂ ਦੀ ਮਦਦ ਨਾਲ ਗਿਆਨ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ ਜੋ ਲੋਕ ਆਡੀਓ ਬੁੱਕ ਸੁਣਦੇ ਹਨ ਉਹ ਰਵਾਇਤੀ ਤਰੀਕੇ ਨਾਲ ਕਿਤਾਬਾਂ ਪੜ੍ਹਨ ਵਾਲਿਆਂ ਦੇ ਮੁਕਾਬਲੇ ਸਮੇਂ ਦੇ ਨਾਲ ਬਿਹਤਰ ਜਾਣਕਰਾ ਜਾਣਕਾਰੀ ਬਰਕਰਾਰ ਰੱਖਦੇ ਹਨ ਕਿਉਂਕਿ ਆਡੀਓ ਬੁੱਕਾਂ ਪੜ੍ਹਨ ਨਾਲ ਸਾਨੂੰ ਬਹੁਤ ਜਾਣਕਾਰੀ ਸਹੀ ਤਰੀਕੇ ਨਾਲ ਅਤੇ ਆਸਾਨੀ ਪ੍ਰਾਪਤ ਹੋ ਜਾਂਦੀ ਹੈ ਓਡੀਓ ਬੁੱਕਾਂ ਤੋਂ ਅਸੀਂ ਬਹੁਤ ਹੀ ਆਸਾਨੀ ਤਰੀਕੇ ਨਾਲ ਬਹੁਤ ਕੁਛ ਸਿੱਖ ਸਕਦੇ ਹਾਂ